ਆਪਾਂ ਜਦੋਂ ਵੀ ਖਾਣਾ ਬਣਾਉਂਦੇ ਹਾਂ ਸਾਨੂੰ ਬਰਤਨ ਸਾਫ਼ ਸੁਥਰੇ ਰੱਖਣੇ ਚਾਹੀਦੇ ਹਨ ਉਹਨਾਂ ਵਿੱਚ ਕੋਈ ਵੀ ਕੀਟਾਣੂ ਨਾ ਰਹਿ ਜਾਵੇ ਗੈਸ ਨੂੰ ਸਾਫ਼ ਰੱਖਣਾ ਚਾਹੀਦਾ ਹੈ ਰਸੋਈ ਟੋਟਲੀ ਸਾਰੀ ਸਾਫ਼ ਹੋਣੀ ਚਾਹੀਦੀ ਆ ਤਾਂ ਕਿ ਗੰਦਗੀ ਨਾ ਰਹੇ ਹਮੇਸ਼ਾ ਖਾਣਾ ਸਾਫ਼ ਸੁਥਰੀ ਜਗ੍ਹਾ 'ਤੇ ਬਣਾਉਂਦੇ ਹਾਂ ਬੱਚਿਆਂ ਨੂੰ ਗੈਸ ਤੋਂ ਦੂਰ ਰੱਖਦੇ ਹਾਂ ਖਾਣਾ ਬਣਾਉਣ ਤੋਂ ਪਹਿਲਾਂ ਗੈਸ ਚੈੱਕ ਕਰਦੇ ਹਾਂ ਅਤੇ ਉਸ ਗੈਸ ਹਮੇਸ਼ਾ ਰਸੋਈ ਤੋਂ ਬਾਹਰਵਾਰ ਹੁੰਦਾ ਹੈ ਅਤੇ ਖਾਣਾ ਬਣਾਉਣ ਸਮੇਂ ਹੱਥਾਂ 'ਤੇ ਗਲੱਵਜ ਅਤੇ ਸਿਰ ਢੱਕ ਕੇ ਰੱਖਦੇ ਹਾਂ ਤਾਂ ਕਿ ਕੋਈ ਵੀ ਕੀਟਾਣੂ ਖਾਣੇ ਵਿੱਚ ਨਾ ਪੈ ਸਕੇ ਖਾਣਾ ਬਣਨ ਤੋਂ ਬਾਅਦ ਅਸੀਂ ਉਸਨੂੰ ਜਾਲੀ ਨਾਲ ਜਾ ਢੱਕਣ ਨਾਲ ਢੱਕ ਕੇ ਰੱਖਦੇ ਹਾਂ ਖਾਣਾ ਹਮੇਸ਼ਾ ਸਾਫ਼ ਸੁਥਰੀ ਜਗ੍ਹਾ 'ਤੇ ਬਣਾਉਂਦੇ ਹਾਂ ਖਾਣੇ ਨੂੰ ਹਮੇਸ਼ਾ ਠੰਡੀ ਜਗ੍ਹਾ 'ਤੇ ਰੱਖਦੇ ਹਾਂ